ਮੈ ਸ਼ੀਤਲ ਕੁਮਾਰੀ ਵਾਸੀ ਮਿਰਜ਼ਾਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਟਰਾਂਸਪੋਰਟ ਦੇ ਕਿਹੜੇ ਕਿਹੜੇ ਸਾਧਨ ਹਨ ਸਾਡੇ ਇਲਾਕੇ ਵਿੱਚ ਟਰਾਂਸਪੋਰਟ ਦੇ ਅਨੇਕ ਸਾਧਨ ਜਿਵੇਂ ਟਰੱਕ ਆਟੋ ਰਿਕਸ਼ਾ ਰੇਲ ਗੱਡੀ ਹਵਾਈ ਜਹਾਜ਼ ਆਦਿ ਪਰ ਸਾਡੇ ਇਲਾਕੇ ਵਿੱਚ ਮੁੱਖ ਸਾਧਨ ਆਟੋ ਟਰੱਕ ਆਦਿ ਹੀ ਹਨ ਜਿਸ ਤਰ੍ਹਾਂ ਅਸੀਂ ਛੋਟਾ ਮੋਟਾ ਕੋਈ ਸਮਾਨ ਲੈਣਾਂ ਲੈਣ ਜਾਣਾ ਲੈ ਜਾਣਾ ਹੋਵੇ ਤਾਂ ਉਹ ਅਸੀਂ ਆਟੋ ਵਿੱਚ ਲੈ ਕੇ ਚਲੇ ਜਾਂਦੇ ਹਾਂ ਜੇਕਰ ਅਸੀਂ ਕਿਤੇ ਦੂਰ ਤੁਹਾਡੇ ਕੋਈ ਭਾਰੇ ਸਮਾਨ ਸਮਾਨ ਪਹੁੰਚਾਉਣਾ ਹੋਵੇ ਤਾਂ ਉਹ ਟਰੱਕਾਂ ਵਿੱਚ ਲਿਜਾ ਕੇ ਲਿਜਾ ਸਕਦੇ ਹਾਂ ਜੇਕਰ ਹੋਰ ਬਹੁਤ ਦੂਰ ਸਮਾਨ ਟਰੇਨ ਵਿੱਚ ਲਿਜਾ ਸਕਦੇ ਹਾਂ ਇਹ ਸਾਧਨ ਹਵਾਈ ਜਹਾਜ਼ ਨਾਲ ਵੀ ਕੀਤਾ ਜਾਂਦਾ ਹੈ ਟਰਾਂਸਪੋਰਟ ਇੱਕ ਅਜਿਹਾ ਸਾਧਨ ਹੈ ਜਿਸ ਦਾ ਸਾਨੂੰ ਬੜਾ ਹੀ ਲਾਭ ਮਿਲਦਾ ਹੈ ਅੱਜ ਕੱਲ੍ਹ ਆਨਲਈਨ ਸ਼ਾਪਿੰਗ ਹੋਣ ਦੇ ਨਾਲ ਛੋਟਾ ਮੋਟਾ ਸਮਾਨ ਜਿਹੜਾ ਕਿ ਸਾਨੂੰ ਹੋਮ ਡਿਲਿਵਰੀ ਵਿੱਚ ਮਿਲ ਜਾਂਦਾ ਹੈ ਉਹ ਮੋਬਾਈਲ ਮੋਟਰਸਾਈਕਲ ਦਾ ਹੀ ਇਕ ਆਦਮੀ ਆ ਕੇ ਉਸ ਨੂੰ ਡਿਲੀਵਰ ਕਰ ਦਿੰਦਾ ਹੈ ਸਾਡੇ ਤੱਕ ਉਹ ਪਹੁੰਚਾਉਣ ਦੀ ਇੱਕ ਟਰਾਂਸਪੋਰਟ ਵਰਗਾ ਹੀ ਹੈ ਜਿਸ ਤਰ੍ਹਾਂ ਪਹਿਲਾਂ ਉਹ ਜਹਾਜ਼ ਵਿੱਚ ਆਉਂਦਾ ਹੈ ਅੱਗੇ ਟਰੇਨ ਵਿੱਚ ਆਉਂਦਾ ਹੈ ਅੱਗੇ ਟਰੱਕ ਵਿੱਚ ਜਾ ਕੇ ਐਟੋ ਵਿੱਚ ਆ ਕੇ ਫਿਰ ਮੋਟਰਸਾਈਕਲ 'ਤੇ ਉਸ ਨੂੰ ਅੱਗੇ ਛੋਟੇ ਮੋਟੇ ਸਾਧਨ 'ਤੇ ਨਾਲ ਇੱਕ ਆਦਮੀ ਡਿਲੀਵਰ ਲੋਕਾਂ ਦੇ ਘਰਾਂ ਵਿੱਚ ਡਿਲੀਵਰ ਕਰ ਦਿੰਦਾ ਹੈ ਇਹ ਸਾਧਨ ਬੜਾ ਹੀ ਵਧੀਆ ਹੈ ਅਤੇ ਇਹ ਸਸਤਾ ਹੈ ਇਸਦੇ ਨਾਲ ਹੀ ਅਸੀਂ ਕਿ ਕਹਿ ਸਕਦੇ ਹਾਂ ਕਿ ਅਸੀਂ ਅਜਿਹੇ ਸਾਧਨਾਂ ਦਾ ਵਰਤੋਂ ਨਾਲ ਬੜੇ ਹੀ ਵਧੀਆ ਬਣ ਗਏ ਹਾਂ ਕਿ ਕੁਝ ਹੀ ਸਮੇਂ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਸਾਡੇ ਤੱਕ ਸਮਾਨ ਪੁੱਜ ਜਾਂਦਾ ਹੈ ਧੰਨਵਾਦ ਜੀ